ਥੋੜ੍ਹੇ ਦਿਨ ਪਹਿਲਾਂ ਮੈਂ ਯੂਟਿਊਬ ਤੋਂ ਦਾਲ ਮੱਖਣੀ ਦੀ ਰੈਸਪੀ ਕੋਪੀ ਕੀਤੀ ਸੀ ਅਤੇ ਮੈਂ ਉਸਨੂੰ ਬਣਾਉਣ ਲਈ ਜਦੋਂ ਉਹ ਰੈਸਪੀ ਦੀ ਪਾਲਣਾ ਕੀਤੀ ਤਾਂ ਥੋੜ੍ਹਾ ਜਿਹਾ ਮੈਤੋਂ ਨਮਕ ਜ਼ਿਆਦਾ ਪੈ ਗਿਆ ਜਿਸ ਕਾਰਨ ਦਾਲ ਦਾ ਸਵਾਦ ਸਾਰਾ ਹੀ ਖ਼ਰਾਬ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਮੈਂ ਆਪਣੇ ਮਾਤਾ ਜੀ ਦੀ ਮਦਦ ਨਾਲ਼ ਉਸ ਵਿੱਚ ਕੁਝ ਆਟੇ ਦੀ ਗੋਲੀਆਂ ਮਿਲਾਈਆਂ ਅਤੇ ਉਸ ਤੋਂ ਬਾਅਦ ਅਸੀਂ ਜਦੋਂ ਦੇਖਿਆ ਤਾਂ ਉਸਦਾ ਸਵਾਦ ਬਿਲਕੁਲ ਸਹੀ ਸੀ ਸੋ ਇਸ ਪ੍ਰਕਾਰ ਮੈਂ ਉਸ ਖਾਣੇ ਨੂੰ ਬਰਬਾਦ ਨਹੀਂ ਸੀ ਕਰਨਾ ਚਾਹੁੰਦੀ ਅਤੇ ਇਸ ਮਾਤਾ ਜੀ ਦੀ ਮਦਦ ਨਾਲ਼ ਉਹ ਖਾਣਾ ਸਵਾਦ ਬਣ ਗਿਆ